ਸਾਡੇ ਖੇਤਰ ਵਿੱਚ ਨ ਨੇੜੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਹਨ ਅਤੇ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ ਮੈਂ ਅੰਮ੍ਰਿਤਸਰ ਵਿੱਚ ਹਾਂ ਅੰਮ੍ਰਿਤਸਰ ਵਿੱਚ ਜਿੱਦਾਂ ਧਾਰਮਿਕ ਸਥਾਨ ਗੋਲਡਨ ਟੈਂਪਲ ਹੋ ਗਿਆ ਰਾਮ ਤੀਰਥ ਹੋ ਗਿਆ ਦੁਰਗਿਆਣਾ ਮੰਦਿਰ ਹੋ ਗਿਆ ਜਲ੍ਹਿਆਂਵਾਲਾ ਬਾਗ ਹੋ ਗਿਆ ਇਹਨਾਂ ਚੀ ਇਹਨਾਂ ਥਾਵਾਂ ਦਾ ਬਹੁਤ ਮਹੱਤਵ ਹੈ ਅਤੇ ਮੈਂ ਜਦੋਂ ਵੀ ਮੇਰੇ ਘਰ ਕੋਈ ਪ੍ਰਾਹੁਣਾ ਆਵੇ ਤਾਂ ਮੈਂ ਉਹਨਾਂ ਨੂੰ ਇਸ ਜਗ੍ਹਾ 'ਤੇ ਲੈ ਕੇ ਘੁਮਾਉਣ ਜ਼ਰੂਰ ਜਾਂਦਾ ਹਾਂ ਅਤੇ ਵਾਹਗਾ ਬਾਡਰ ਵੀ ਅੰਮ੍ਰਿਤਸਰ ਵਿੱਚ ਬਹੁਤ ਮਸ਼ਹੂਰ ਹੈ ਉਹ ਵੀ ਦੇਖਣ ਵਾਲੀ ਹੀ ਜਗ੍ਹਾ ਹੈ ਮੈਂ ਇਹਦੇ ਸਾਰੇ ਸਾਮੀਆਂ ਨੂੰ ਇਹੋ ਕਹਾਂਗਾ ਜਦੋਂ ਵੀ ਉਹ ਆਉਣ ਇਸ ਥਾਂ ਅੰਮ੍ਰਿਤਸਰ ਐ ਥਾਵਾਂ ਦਾ ਘੁੰਮ ਕੇ ਆਨੰਦ ਲੈਣ ਬਹੁਤ ਵਧੀਆ ਥਾਵਾਂ ਹਨ ਅਤੇ ਇੱਥੇ ਗੋਲ ਗੋਲਡਨ ਟੈਂਪਲ ਹਰਿਮੰਦਰ ਸਾਹਿਬ ਵਿੱਚ ਫਰੀ ਲੰਗਰ ਚੌਵੀ ਘੰਟੇ ਚੱਲਦਾ ਹੈ ਜਿਸ ਦਾ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਜਦੋਂ ਮਰਜੀ ਲੰਗਰ ਛਕੋ ਅਤੇ ਸ ਚੌਵੀ ਘੰਟੇ ਲੰਗਰ ਦਾ ਆਨੰਦ ਮਾਣੋ ਏ ਜੇ ਮੈਂ ਤਾਂ ਇਹੋ ਕਹਾਂਗਾ ਸਾਰੇ ਜਣੇ ਆਉਣ ਅਤੇ ਸਾਰੀਆਂ ਜਗ੍ਹਾ 'ਤੇ ਜਾਣ ਇਸ ਅੰਮ੍ਰਿਤਸਰ ਗੁਰੂ ਪੀਰਾਂ ਦੀ ਧਰਤੀ ਹੈ ਇਸ ਲਈ ਜ਼ਰੂਰ ਆ ਕੇ ਇਸ ਜਗ੍ਹਾ 'ਤੇ ਸਾਰਿਆਂ ਨੂੰ ਜਾਣਾ ਚਾਹੀਦਾ ਹੈ